ਮੈਂ ਆਪਣੇ ਲਈ ਇੱਕ ਸ਼ਰਟ ਬੱਬੂ ਕਲੋਥ ਹਾਊਸ ਤੋਂ ਖਰੀਦੀ ਸੀ ਜੋ ਕਿ ਵਧੀਆ ਨਹੀਂ ਨਿਕਲੀ ਕੱਪੜਾ ਵੀ ਮਾੜਾ ਸੀ ਅਤੇ ਛੇਤੀ ਹੀ ਖਰਾਬ ਹੋ ਗਈ ਹੈ ਇਹ ਮੇਰਾ ਐਕਸਪੀਰੀਅੰਸ